ਹੈਲੋ ਸਵੀਗੀ ਤੋਂ ਬੋਲ ਰਹੇ ਸਰ ਮੈਂ ਇੱਕ ਔਡਰ ਪਾਇਆ ਸੀ ਸਵੀਗੀ ਤੋਂ ਕੁਛ ਖਾਣਾ ਮੰਗਵਾਇਆ ਸੀ ਤਰਨ ਤਾਰਨ ਕੈਫੇ ਅਟਾਲੀਆ ਤੋਂ ਲੇਕਿਨ ਉਹ ਮੈਂ ਦੇਖ ਰਿਹਾ ਮੈਨੂੰ ਅਜੇ ਤੱਕ ਰਿਸੀਵ ਨਹੀਂ ਹੋਇਆ ਪਰ ਜਿਹੜੀ ਮੇਰੀ ਐਪਲੀਕੇਸ਼ਨ ਆ ਉਹਦੇ ਵਿੱਚ ਇਹ ਸ਼ੋਅ ਹੋ ਰਿਹਾ ਕੇ ਉਹ ਮੈਨੂੰ ਡਿਲੀਵਰ ਹੋ ਚੁੱਕਾ ਆ ਮਿਸਟਰ ਸੁਰੇਸ਼ ਜੋ ਕਿ ਡਿਲੀਵਰੀ ਮੈਨ ਹੈ ਪਲੀਜ਼ ਉਹਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਮੇਰਾ ਮੈਨੂੰ ਔਡਰ ਰਿਸੀਵ ਹੋ ਹੋ ਸਕੇ ਮੇਰੇ ਰਿਸ਼ਤੇਦਾਰ ਘਰ ਦੇ ਵਿੱਚ ਵੇਟ ਕਰ ਰਹੇ ਹਨ ਅਤੇ ਮੈਂ ਉਹਨਾਂ ਨੂੰ ਖਾਣਾ ਸਰਵ ਕਰਨਾ ਹੈ ਇਸ ਕਰਕੇ ਛੇਤੀ ਤੋਂ ਛੇਤੀ ਮੇਰੀ ਮਦਦ ਕੀਤੀ ਜਾਵੇ ਨਹੀਂ ਤਾਂ ਮੇਰੇ ਪੈਸੇ ਜਿੰਨੇ ਲੱਗੇ ਹਨ ਉਹ ਸਾਰੇ ਰਿਫੰਡ ਕੀਤੇ ਜਾਣ ਤਾਂ ਜੋ ਮੈਂ ਦੁਬਾਰਾ ਔਡਰ ਪਾ ਸਕਾਂ ਅਤੇ ਇਹ ਗਲਤੀ ਦੁਬਾਰਾ ਨਾ ਦੋਹਰਾਈ ਜਾਵੇ ਮੈਂ ਇਹ ਬੇਨਤੀ ਕਰਦਾ ਹਾਂ ਕਿਉਂਕਿ ਇਸ ਤਰ੍ਹਾਂ